ਹੈਲੋ ਹਾਂਜੀ ਸਟੇਸ਼ਨ ਮਾਸਟਰ ਜੀ ਬੋਲਦੇ ਨੇ ਹਾਂਜੀ ਸਰ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਸੀ ਕਿ ਜੋ ਹੁਣ ਆਪਣੇ ਇੱਥੇ ਸ਼ਾਮ ਨੂੰ ਟਰੇਨ ਚੱਲਣੀ ਸੀ ਦਿੱਲੀ ਲਈ ਉਹ ਟਰੇਨ ਦੀ ਜਿਹੜੀ ਹੈਗੀ ਮੈਂ ਆਨਲਾਈਨ ਟਿਕਟਾਂ ਬੁੱਕ ਕਰਵਾਈਆ ਸੀ ਅਤੇ ਮੇਰੀ ਰਿਜ਼ਰਵੇਸ਼ਨ ਬੁੱਕ ਹੈਗੀ ਹੈ ਅਤੇ ਪਰ ਹੁਣ ਇਸ ਟਾਈਮ ਦੇ ਉੱਪਰ ਉਹ ਟਰੇਨ ਦੇ ਬਾਰੇ ਦੇ ਵਿੱਚ ਆਨਲਾਈਨ ਕੋਈ ਸੂਚਨਾ ਨਹੀਂ ਆ ਰਹੀ ਹੈ ਅਤੇ ਨਾ ਹੀ ਇਹ ਪਤਾ ਲੱਗ ਰਿਹਾ ਹੈ ਕਿ ਉਹ ਟਰੇਨ ਐਟ ਪ੍ਰੈਜੈਂਟ ਕਿੱਥੇ ਹੈਗੀ ਹੈ ਅਤੇ ਮੈਨੂੰ ਇਹ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ ਕਿ ਉਹ ਟਰੇਨ ਕੀ ਇੱਥੋਂ ਦੇ ਸਹੀ ਟਾਈਮ 'ਤੇ ਹੀ ਚੱਲੇਗੀ ਜਾਂ ਉਸ ਟਰੇਨ ਦੇ ਟਾਈਮ ਟੇਬਲ ਦੇ ਵਿੱਚ ਕੋਈ ਚੇਂਜ ਹੈ ਸਰ ਮੈਂ ਆਨਲਾਈਨ ਪਤਾ ਕਰਿਆ ਹੈ ਅਤੇ ਉਹ ਸ਼ਾਇਦ ਉਸਦੇ ਵਿੱਚ ਕੋਈ ਗੜਬੜ ਚੱਲ ਰਹੀ ਹੈ ਤੁਹਾਡੇ ਐਪ ਦੇ ਵਿੱਚ ਅਤੇ ਉਹਦੇ ਵਿੱਚ ਉਹ ਟਰੇਨ ਦਾ ਸਹੀ ਟਾਈਮ ਨਹੀਂ ਦੱਸ ਰਹੇ ਨੇ ਤਾਂ ਪਲੀਜ਼ ਤੁਸੀਂ ਮੈਨੂੰ ਇਹ ਦੱਸਣ ਦੀ ਕਿਰਪਾ ਕਰੋ ਕਿ ਇਹ ਟਰੇਨ ਦਾ ਸਹੀ ਟਾਈਮ ਕੀ ਹੈ